ਮੈਂ ਫ਼ੋਨ ਵਿੱਚ ਗੇਮ ਖੇਡਣਾ ਬਹੁਤ ਪਸੰਦ ਕਰਦਾ ਹਾਂ ਜਿਸ ਕਾਰਨ ਮੇਰੇ ਫ਼ੋਨ ਵਿੱਚ ਬਹੁਤ ਸਾਰੀਆਂ ਗੇਮਾਂ ਵੀ ਹਨ ਅਤੇ ਉਹਨਾਂ ਵਿੱਚੋਂ ਕਈ ਗੇਮਾਂ ਨੂੰ ਮੈਂ ਬਹੁਤ ਪਸੰਦ ਵੀ ਕਰਦਾ ਹਾਂ ਜਿਸ ਵਿੱਚੋਂ ਪਬਜੀ ਨਾਮ ਦੀ ਗੇਮ ਮੇਰੀ ਸਭ ਤੋਂ ਮਨਪਸੰਦ ਗੇਮ ਹੈ ਉਸ ਗੇਮ ਵਿੱਚ ਟੋਟਲ ਸੌ ਬੰਦੇ ਅਲੱਗ ਅਲੱਗ ਦੇਸ਼ਾਂ ਤੋਂ ਅਲੱਗ ਅਲੱਗ ਜਗ੍ਹਾਵਾਂ ਤੋਂ ਔਨਲਾਈਨ ਇਕੱਠੇ ਹੋ ਕੇ ਇੱਕ ਗੇਮ ਵਿੱਚ ਹੀ ਖੇਲ ਸਕਦੇ ਹਨ ਅਤੇ ਉਸ ਗੇਮ ਵਿੱਚ ਜਿਹੜਾ ਬੰਦਾ ਅਖੀਰ ਤੱਕ ਬੱਚਦਾ ਹੈ ਉਸ ਨੂੰ ਵਿਜੈਈ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਅਤੇ ਉਸ ਗੇਮ ਵਿੱਚ ਪ੍ਰਾਈਜ਼ ਵੀ ਮਿਲਦੇ ਹਨ ਜਿਵੇਂ ਤੁਹਾਡੇ ਜਿਹੜਾ ਉਹਦੇ ਵਿੱਚ ਕਰੈਕਟਰ ਹੁੰਦਾ ਹੈ ਬੰਦਾ ਹੁੰਦਾ ਹੈ ਉਸ ਨੂੰ ਨਵੇਂ ਕੱਪੜੇ ਮਿਲ ਜਾਂਦੇ ਹਨ ਉਸਦੀ ਭੱਜਣ ਦੀ ਸ਼ਕਤੀ ਥੋੜ੍ਹੀ ਤੇਜ਼ ਹੋ ਜਾਂਦੀ ਹੈ ਇੱਦਾਂ ਦੀਆਂ ਗੇਮਾਂ ਹੀ ਮੇਰੇ ਫ਼ੋਨ ਵਿੱਚ ਹਨ ਅਤੇ ਇਸ ਤੋਂ ਇਲਾਵਾ ਕਈ ਬਿਨਾਂ ਨੈੱਟ ਤੋਂ ਚੱਲਣ ਵਾਲੀਆਂ ਗੇਮਾਂ ਵੀ ਹਨ ਜੋ ਕਿ ਮੈਂ ਵੈਸੇ ਹੀ ਆਪਣੇ ਵਿਹਲੇ ਸਮੇਂ ਵਿੱਚ ਟਾਈਮਪਾਸ ਕਰਨ ਲਈ ਖੇਡ ਲੈਂਦਾ ਹਾਂ ਅਤੇ ਉਸ ਨਾਲ਼ ਮੇਰਾ ਚੰਗਾ ਟਾਈਮਪਾਸ ਵੀ ਹੋ ਜਾਂਦਾ ਹੈ